ਹੈਲੋ ਮੇਰਾ ਨਾਮ ਸੰਜਨਾ ਹੈ ਮੈਂ ਅੱਜ ਤੁਹਾਨੂੰ ਚੋਕਲੇਟ ਕੇਕ ਬਣਾਉਣ ਬਾਰੇ ਦੱਸ ਰਹੀ ਹਾਂ ਸਾਨੂੰ ਚੋਕਲੇਟ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਬਾਉਲ ਲੈਣਾ ਹੈ ਜਿਸ ਨੂੰ ਸਾਨੂੰ ਫਿਰ ਇੱਕ ਕੱਪ ਮੈਦਾ ਦਾ ਚਾਹੀਦਾ ਹੈ ਹੈਗਾ ਏ ਇੱਕ ਚਮਚ ਸਾਨੂੰ ਰਿਫਾਇੰਡ ਚਾਹੀਦੀ ਹੈ ਚੀਨੀ ਪੀਸੀ ਹੋਈ ਅਤੇ ਥੋੜ੍ਹੀ ਜਿਹੀ ਦਹੀ ਇੱਕ ਚਮਚ ਦਹੀ ਹੋਵੇ ਅਤੇ ਸਾਨੂੰ ਚੋਕਲੇਟ ਪਾਊਡਰ ਹੋ ਗਿਆ ਮੈਲਟ ਕੀਤੀ ਹੋਈ ਚੋਕਲੇਟ ਹੋ ਗਈ ਸਾਨੂੰ ਇਹਨਾਂ ਸਾਰਿਆਂ ਦਾ ਪੇਸਟ ਬਣਾਉਣਾ ਸਾਰਿਆਂ ਨੂੰ ਮਿਕਸ ਕਰਨਾ ਹੈਗਾ ਏ ਸਾਰੇ ਇੱਕ ਬੇਕਿੰਗ ਸੋਡਾ ਇਹਨਾਂ ਨੂੰ ਸਾਰਿਆਂ ਨੂੰ ਪਾ ਕੇ ਮਿਕਸ ਕਰਕੇ ਸਾਨੂੰ ਇਹਨਾਂ ਨੂੰ ਇੱਕ ਬਾਉਲ ਬੜੀ ਜਿਹੀ ਬਾਉਲ ਵਿੱਚ ਪਾ ਕੇ ਇਹਨਾਂ ਨੂੰ ਸਾਨੂੰ ਓਵਨ ਵਿੱਚ ਰੱਖ ਦੇਣਾ ਏ ਪੰਜ ਦਸ ਮਿੰਟ ਲਈ ਸਾਨੂੰ ਇਹਨਾਂ ਨੂੰ ਰੱਖ ਦੇਣਾ ਪੱਕਣ ਲਈ ਜਦ ਨੂੰ ਇਹ ਸਾਨੂੰ ਮਤਲਬ ਪੰਜ ਦਸ ਮਿੰਟ ਲਈ ਵੇਟ ਕਰਨਾ ਪੈਣਾ ਏ ਜਦ ਇਹ ਬਣਜੂੰਗਾ ਉਸ ਤੋਂ ਬਾਅਦ ਸਾਨੂੰ ਮਤਲਬ ਅੱਗੇ ਥੋੜ੍ਹਾ ਜਿਹਾ ਠੰਡਾ ਹੋ ਕੇ ਦੂਜੇ ਪਲੇਟ ਵਿੱਚ ਕੱਢ ਕੇ ਇਹਨੂੰ ਕੱਟਣਾ ਏ ਮਤਲਬ ਕਿ ਜਿੰਨਾ ਵੀ ਉਹਦਾ ਪੀਸ ਬਣਾਉਣਾ ਤੁਸੀਂ ਉਹਦੇ ਹਿਸਾਬ ਨਾਲ਼ ਕੱਟ ਕੇ ਵਿਪਡ ਕਰੀਮ ਲਗਾ ਕੇ ਉਹਨੂੰ ਚੰਗੀ ਤਰ੍ਹਾਂ ਮਤਲਬ ਕ੍ਰੀਮ ਨਾਲ਼ ਚੰਗੀ ਤਰ੍ਹਾਂ ਮਿਲਟ ਕਰਕੇ ਲਗਾ ਕੇ ਪੈਕ ਕਰਕੇ ਤੁਸੀਂ ਉਹਦੇ ਉੱਪਰ ਚੋਕਲੇਟ ਜੇ ਉਹਨੂੰ ਮਤਲਬ ਕਿ ਸਜਾਉਣ ਲਈ ਕੁਝ ਵੀ ਉਹਦੇ ਉੱਪਰ ਅਤੇ ਕਰੀਮ ਲਗਾ ਸਕਦੇ ਹੋ ਚੋਕਲੇਟ ਛੋਟੀ ਛੋਟੀ ਚੋਕਲੇਟ ਹੋ ਗਈ ਸਿਲਵਰ ਚੋਕਲੇਟ ਹੋ ਗਈ ਸਾਰਾ ਉਹਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਫਿਰ ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਕੱਟ ਕੇ ਸਰਵ ਕਰਨਾ ਹੁੰਦਾ ਅਤੇ ਕਾਫ਼ੀ ਸੋਫਟ ਅਤੇ ਟੇਸਟੀ ਬਣਦਾ ਏ